ਭਾਰਤੀ ਆਵਾਜਾਈ ਪ੍ਰਣਾਲੀ ਜੇ ਮੈਂ ਆਪਣੇ ਪੱਖ ਤੋਂ ਦੇਖਾਂ ਤਾਂ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਇਹਦੇ ਵਿੱਚ ਸਰਕਾਰ ਵੱਲੋਂ ਰੋਡਵੇਜ਼ ਬੱਸਾਂ ਅਤੇ ਰੇਲ ਗੱਡੀਆਂ ਕਾਫੀ ਚਲਾਈਆਂ ਗਈਆਂ ਨੇ ਜਿਹਦੇ ਵਿੱਚ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਕੋਈ ਬਹੁਤਾ ਮੁਸ਼ਕਿਲ ਨਹੀਂ ਲੱਗਦਾ ਇਹਨਾਂ ਦਾ ਖਰਚ ਵੀ ਬਹੁਤ ਘੱਟ ਹੁੰਦਾ ਅਤੇ ਜੇ ਪ੍ਰਾਈਵੇਟ ਬੱਸਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਬੱਸਾਂ ਵੀ ਬਹੁਤ ਜ਼ਿਆਦਾ ਜਿਹੜੀਆਂ ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਇੱਕ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਜਿਹੜੇ ਲੋਕ ਨੇ ਭਾਰਤ ਦੇ ਉਹ ਥੋੜ੍ਹਾ ਜਿਹਾ ਆਪਣੇ ਪ੍ਰਾਈਵੇਟ ਵਹੀਕਲਸ 'ਤੇ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਜਿਵੇਂ ਉਹਨਾਂ ਨੇ ਆਪਣੀਆਂ ਕਾਰਾਂ ਲੈ ਲਈਆਂ ਨੇ ਤਾਂ ਉਹ ਜ਼ਿਆਦਾ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਆਪਣੀਆਂ ਕਾਰਾਂ 'ਤੇ ਅਤੇ ਇਹ ਚੁਣੌਤੀ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਂਦਾ ਕਿਉਂਕਿ ਜਦੋਂ ਉਹ ਆਪਣੇ ਇਕੱਲੇ ਇਕੱਲੇ ਜਾਣਾ ਇੱਕ ਇੱਕ ਆਪਣੀ ਕਾਰ ਲੈ ਕੇ ਜਾਂਦਾ ਤਾਂ ਉਹਦੇ ਨਾਲ ਪਲਿਊਸ਼ਨ ਵੱਧਦਾ ਹੀ ਹੈ ਅਤੇ ਸਰਕਾਰ ਨੂੰ ਵੀ ਇਸ ਚੀਜ਼ ਦਾ ਬਹੁਤ ਘਾਟਾ ਪੈਂਦਾ ਜਦੋਂ ਪਬਲਿਕ ਟ੍ਰਾਂਸਪੋਰਟ 'ਤੇ ਜਿਹੜੇ ਭਾਰਤੀ ਨਾਗਰਿਕ ਨੇ ਨਹੀਂ ਚੜਦੇ ਹੈਗੇ ਅਤੇ ਦੂਸਰਾ ਸੜ ਕਈ ਥਾਵਾਂ 'ਤੇ ਸੜਕਾਂ ਵਗੈਰਾ ਦੀ ਪ੍ਰੋਬਲਮ ਹੈਗੀ ਓ ਉਹ ਮੇਨ ਪ੍ਰੋਬਲਮ ਆ ਰਹੀ ਆ ਜਿਹੜੀ ਆਵਾਜਾਈ ਦੇ ਵਿੱਚ ਬਾਕੀ ਓਵਰਆਲ ਜਿਹੜੀ ਭਾਰਤ ਦੀ ਆਵਾਜਾਈ ਪ੍ਰਣਾਲੀ ਹੈ ਸਹੀ ਹੈ ਜਿ ਜਿਹੜੀਆਂ ਕੁਛ ਕੁ ਚੁਣੌਤੀਆਂ ਨੇ ਉਹਨਾਂ ਨੂੰ ਸੁਧਾਰਨ ਦੇ ਵਿੱਚ ਸਰਕਾਰ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਆ ਇੱਕ ਤਾਂ ਉਹ ਸੜਕਾਂ 'ਤੇ ਥੋੜ੍ਹਾ ਜਿਹਾ ਫੋਕਸ ਕਰਨ ਵੀ ਕਿਵੇਂ ਇਹਨਾਂ ਨੂੰ ਤ ਸੁਧਾਰੀਏ ਜਿਹੜੇ ਠੇਕੇਦਾਰ ਠੇਕੇ ਲੈਂਦੇ ਨੇ ਸੜਕਾਂ ਬਣਾਉਣ ਦੇ ਉਹ ਦੇਖਣ ਵੀ ਉਹ ਜਿਹੜਾ ਪੈਸਾ ਉਹਨਾਂ ਨੂੰ ਦਿੰਦੇ ਨੇ ਵੀ ਉਹ ਪ੍ਰੋਪਰ ਸੜਕਾਂ 'ਤੇ ਲਾਉਣ ਖਾਣ ਦੀ ਬਜਾਏ ਉਹਨਾਂ ਨੂੰ ਅਤੇ ਦੂਸਰਾ ਜਿਹੜਾ ਫੂਡ ਹੈ ਪੂਰੇ ਭਾਰਤ ਦੇ ਵਿੱਚ ਸੇਮ ਨਹੀਂ ਮਿਲਦਾ ਜਦੋਂ ਯਾਤਰੀ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਨੇ ਆਵਾਜਾਈ ਦੇ ਵਿੱਚ ਤਾਂ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਤਾਂ ਪੂਰੇ ਮਤਲਬ ਜਦੋਂ ਮੰਨ ਲਉ ਉਦਾਹਰਣ ਦੇ ਤੌਰ 'ਤੇ ਉੱਤਰ ਭਾਰਤੀ ਜੋ ਦੱਖਣੀ ਭਾਰਤ 'ਚ ਕੋਈ ਯਾਤਰੀ ਯਾਤਰਾ ਕਰਨ ਜਾ ਰਿਹਾ ਤਾਂ ਜਿਹੜਾ ਉੱਤਰੀ ਭਾਰਤ ਦਾ ਖਾਣਾ ਹੈਗਾ ਉਹ ਦੱਖਣੀ ਭਾਰਤ ਦੇ ਵਿੱਚ ਵੀ ਮਿਲਣਾ ਚਾਹੀਦਾ